ਮੈਂ ਪੈਨਾਸੋਨਿਕ ਦਾ ਇੱਕ ਟਨ ਦਾ ਏ ਸੀ ਦੋ ਹਜ਼ਾਰ ਬਾਈ ਵਿੱਚ ਖਰੀਦਿਆ ਸੀ ਉਸ ਸਮੇਂ ਦੋ ਮਹੀਨੇ ਹੀ ਚੱਲਿਆ ਐਤਕੀ ਦੋ ਹਜਾਰ ਤੇਈ ਵਿੱਚ ਜਦੋਂ ਹੁਣ ਗਰਮੀ ਪੈਣ 'ਤੇ ਆਪਣਾ ਜੂਨ ਮਹੀਨੇ ਵਿੱਚ ਸਟਾਰਟ ਕਰਿਆ ਤਾਂ ਉਸਦੀ ਕੁਲਿੰਗ ਜ਼ੀਰੋ ਰਹੀ ਅਤੇ ਜਦੋਂ ਮੈਂ ਕੰਪਨੀ ਨੂੰ ਫ਼ੋਨ ਕਰਿਆ ਤਾਂ ਕੰਪਨੀ ਵਾਲੇ ਪਹਿਲਾਂ ਲਾਰਾ ਲਾਉਂਦੇ ਰਹੇ ਅਤੇ ਮੁੜ ਕੇ ਕਹਿੰਦੇ ਵੀ ਚਾਰ ਹਜ਼ਾਰ ਰੁਪਇਆ ਗੈਸ ਦਾ ਲੱਗੂ ਜਦੋਂ ਮੈਂ ਉਹਨਾਂ ਕੰਪਨੀ ਨੂੰ ਕਿਹਾ ਵੀ ਇਹ ਗ ਗੈਸ ਲੀਕ ਕਾਹਤੇ ਕਰੀ ਆ ਅਤੇ ਇਹਦਾ ਫਲਟ ਆ ਜੇ ਗੈਸ ਪਾਤੀ ਮੁੜਕੇ ਫਿਰ ਲੀਕ ਕਰ ਜਾਣੀ ਅਤੇ ਉਸ ਬਾਰੇ ਕੁਛ ਉਹਨਾਂ ਜਵਾਬ ਨਹੀਂ ਦਿੱਤਾ ਲ ਵਾਰ ਵਾਰ ਲਾਰੇ ਲਾਉਂਦੇ ਰਹੇ ਉਸ ਤੋਂ ਬਾਅਦ ਮੈਂ ਪ੍ਰਾਈਵੇਟ ਬੰਦਾ ਲੈ ਕੇ ਤਿੰਨ ਹਜ਼ਾਰ ਰੁਪਏ ਦੀ ਗੈਸ ਭਰਵਾਈ ਅਤੇ ਤਾਂ ਚਾਲੂ ਕੀਤਾ ਉਹ ਹੈ ਸੀ ਕੰਪਨੀ ਵਧੀਆ ਨਹੀਂ ਰਹੀ ਹੈਗੀ